ਵੈਸੇ ਤਾਂ ਪੰਜਾਬ ਦੇ ਲਗ ਸਾਰੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਆਰਟ ਗੈਲਰੀਆਂ ਹਨ ਪਰ ਇਹਨਾਂ ਵਿੱਚੋਂ ਕੁਛ ਮੁੱਖ ਆਰਟ ਗੈਲਰੀਆਂ ਹਨ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਬਹੁਤ ਵੱਡੀ ਆਰਟ ਗੈਲਰੀ ਹੈ ਜੋ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ ਅਤੇ ਇਸ ਤਰ੍ਹਾਂ ਹੀ ਸ਼ੀਸ਼ ਮਹਿਲ ਪਟਿਆਲਾ ਦੇ ਵਿੱਚ ਬਹੁਤ ਵੱਡੀ ਆਰਟ ਗੈਲਰੀ ਜਿਹਦੇ ਵਿੱਚ ਪੁਰਾਣੇ ਸਮੇਂ ਦੇ ਹਥਿਆਰ ਅਤੇ ਪੁਰਾਣੇ ਸਮੇਂ ਦੀਆਂ ਰਾਜੇ ਮਹਾਰਾਜਿਆਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਹਨ ਉਹ ਚੀਜ਼ਾਂ ਜੋ ਬਹੁਤ ਪੁਰਾਣੀਆਂ ਹਨ ਅਤੇ ਇੱਦਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਜਲਿਆਂ ਵਾਲੇ ਬਾਗ ਦੇ ਵਿੱਚ ਇੱਕ ਆਰਟ ਗੈਲਰੀ ਹੈ ਅਤੇ ਉੱਥੇ ਵੀ ਬਹੁਤ ਵਿਰਾਸਤੀ ਆਰਟ ਦਿਖਾਇਆ ਗਿਆ ਹੈ ਅਤੇ ਖਾਲਸਾ ਕੋਲਜ ਅੰਮ੍ਰਿਤਸਰ ਉੱਥੇ ਵੀ ਆਰਟ ਗੈਲਰੀ ਹੈ ਅਤੇ ਇੱਦਾਂ ਹੀ ਲੁਧਿਆਣਾ ਦੇ ਵਿੱਚ ਜੱਸਲ ਆਰਟ ਗੈਲਰੀ ਅਰਾਧਨਾ ਆਰਟ ਗੈਲਰੀ ਮੱਟਾ ਆਰਟ ਗੈਲਰੀ ਮਨਮੋਹਨ ਆਰਟ ਗੈਲਰੀ ਅਤੇ ਮਲਹਾਰ ਆਰਟ ਗੈਲਰੀ ਅਤੇ ਬਹੁਤ ਸਾਰੀਆਂ ਆਰਟ ਗੈਲਰੀਆਂ ਹਨ ਅਤੇ ਬਹੁਤ ਸਾਰੀਆਂ ਪ੍ਰਾਈਵੇਟ ਅਤੇ ਗੈਰ ਸਰਕਾਰੀ ਸਰਕਾਰੀ ਅਤੇ ਗੈਰ ਸਰਕਾਰੀ ਬਹੁਤ ਆਰਟ ਗੈਲਰੀਆਂ ਹਨ

ਕੁਝ ਖਾਸ ਆਰਟ ਗੈਲਰੀਆਂ ਜਿਹੜੀਆਂ ਉਹ ਮੇਨ ਸ਼ਹਿਰਾਂ ਦੇ ਵਿੱਚ ਹਨ ਜਿੱਥੇ ਕਿ ਵਿਰਾਸਤੀ ਸੱਭਿਆਚਾਰਕ ਚੀਜ਼ਾਂ ਵੀ ਨਾਲ ਦਿਖਾਈਆਂ ਜਾਂਦੀਆਂ ਹਨ ਬਾਕੀ ਹੋਰ ਬਹੁਤ ਸਾਰੀਆਂ ਆਰਟ ਗੈਲਰੀਆਂ ਹਨ ਜੋ ਸੱਭਿਆਚਾਰਕ ਅਤੇ ਸਾਜ਼ੋ ਸਮਾਨ ਨਾਲ ਭਰਪੂਰ ਹਨ